ਮੇਰੀ ਪਹਿਲੀ ਨੌਕਰੀ ਦੋ ਹਜ਼ਾਰ ਸਤਾਰਾਂ ਵਿੱਚ ਸ਼ੁਰੂ ਹੋਈ ਜਦੋਂ ਮੈਂ ਨੌਕਰੀ 'ਚ ਪ੍ਰਵੇਸ਼ ਕੀਤਾ ਤਾਂ ਮੈਂ ਐਕਟੀਵਾ 'ਤੇ ਹੁੰਦਾ ਸੀ ਅਤੇ ਮੇਰਾ ਫਿਰ ਵੀ ਮਨ ਬਾਈਕਿੰਗ ਵਾਲੇ ਪਾਸੇ ਸੀ ਮੇਰਾ ਉੱਥੇ ਦਫ਼ਤਰ 'ਚ ਇੱਕ ਦੋਸਤ ਬਣਿਆ ਜਿਹਦੇ ਨਾਲ ਮੈਂ ਕਦੇ ਮਾਰਕੀਟ ਘੁੰਮਣਾ ਹੋਵੇ ਤਾਂ ਉਹਦੀ ਬਾਈਕ 'ਤੇ ਜਾਣਾ ਫਿਰ ਹੌਲੀ ਹੌਲੀ ਸਾਡੀ ਜਦੋਂ ਮਿੱਤਰਤਾ ਗੂੜੀ ਹੋਈ ਤਾਂ ਉਹਨੇ ਮੈਨੂੰ ਇੱਕ ਦੋ ਵਾਰ ਮੈਨੂੰ ਕਿਹਾ ਕਿ ਤੂੰ ਵੀ ਬਾਈਕ ਚਲਾਇਆ ਕਰ ਫਿਰ ਥੋੜ੍ਹੀ ਬਹੁਤ ਵਿਕਸਿਤ ਹੋਈ ਮੇਰੀ ਪ੍ਰੇਰਣਾ ਤੋਂ ਮੈਂ ਪ੍ਰਭਾਵਿਤ ਹੋਇਆ ਅਤੇ ਮੈਂ ਉਹਦੀ ਬਾਈਕ ਕਦੇ ਕਦੇ ਚਲਾਉਣੀ ਸ਼ੁਰੂ ਕੀਤੀ ਅਤੇ ਫਿਰ ਹੌਲੀ ਹੌਲੀ ਮੈਂ ਆਪਣਾ ਹੱਥ ਪੱਕਾ ਕੀਤਾ ਜਦੋਂ ਵੀ ਜਿੱਥੇ ਜਾਣਾ ਉਹਨੇ ਮੈਨੂੰ ਕਹਿਣਾ ਕਿ ਤੂੰ ਚਲਾ ਜਿਹਦੇ ਨਾਲ ਮੈਂ ਆਪਣੀ ਬਾਈਕ ਕੱਲ੍ਹ ਨੂੰ ਜੇ ਲਈ ਤਾਂ ਮੈਨੂੰ ਉਹਦੇ ਲਈ ਸਹੂਲਤ ਰਹੇਗੀ ਫਿਰ ਲਗਭਗ ਦੋ ਸਾਲ ਬਾਅਦ ਉਹ ਸਮਾਂ ਆਇਆ ਜਦੋਂ ਮੈਂ ਆਪਣੀ ਇੱਕ ਬਾਈਕ ਲਈ ਜੋ ਕਿ ਸਪੋਰਟਸ ਬਾਈਕ ਸੀ ਹੁਣ ਵੀ ਅੱਜ ਮੈਨੂੰ ਲਗਭਗ ਪੰਜ ਤੋਂ ਛੇ ਸਾਲ ਉਸ ਬਾਈਕ ਨੂੰ ਚਲਾਉਂਦਿਆਂ ਹੋ ਗਏ ਹਨ ਅਤੇ ਮੈਂ ਬਹੁਤ ਸਕੂਨ ਮਹਿਸੂਸ ਕਰਦਾ ਹਾਂ ਕਿ ਮੈਨੂੰ ਇਹੋ ਜਿਹਾ ਮਿੱਤਰ ਮਿਲਿਆ ਜਿਹਦੇ ਥਰੂ ਮੈਂ ਇਹੋ ਜਿਹੀ ਬਾਈਕ ਚਲਾਉਣੀ ਸਿੱਖੀ ਅਤੇ ਹੁਣ ਮੈਂ ਜਿਵੇਂ ਸਪੋਰਟਸ ਬਾਈਕ ਚਲਾਉਂਦਾ ਹਾਂ ਅਤੇ ਮੈਂ ਆਪਣਾ ਵਿਕਸਿਤ ਹੋਇਆ ਜੀਵਨ ਆਪਣਾ ਬਹੁਤ ਵਧੀਆ ਬਤੀਤ ਕਰ ਰਿਹਾ ਹਾਂ ਧੰਨਵਾਦ